ਮੈਂ ਸਰ ਔਨਲਾਈਨ ਸ਼ੋਪਿੰਗ ਕਰਦਾ ਰਹਿੰਦਾ ਹਾਂ ਪਰ ਮੈਨੂੰ ਐਮਾਜੋਨ ਦੀ ਸ਼ੋਪਿੰਗ ਜਿਹੜੀ ਹੈ ਨਾ ਬਹੁਤ ਹੀ ਵਧੀਆ ਲੱਗੀ ਆ ਉਹ ਜੋ ਡਿਲੀਵਲੀ ਵਾਲੇ ਮੁੰਡੇ ਆ ਬਹੁਤ ਵਧੀਆ ਉਹਨਾਂ ਦੀ ਸਰਵਿਸ ਆ ਉਹ ਆਪਣੇ ਟਾਈਮ ਦੇ ਨਾਲ ਹੀ ਚੀਜ਼ ਪਹੁੰਚਾ ਦਿੰਦੇ ਬਲਕਿ ਉਸ ਤੋਂ ਪਹਿਲਾਂ ਹੀ ਪਹੁੰਚਾ ਦਿੰਦੇ ਸਾਡੇ ਕੋਲ ਅਸੀਂ ਉਹਨਾਂ ਕੋਲ ਅਕਸਰ ਹੀ ਕੋਈ ਨਾ ਕੋਈ ਸਮਾਨ ਮੰਗਵਾਉਂਦੇ ਰਹਿਦੇ ਹਾਂ ਪਰ ਇਹ ਵੀ ਸਾਨੂੰ ਕਦੇ ਉਹਨਾਂ ਨੂੰ ਕੰਪਲੇਂਟ ਦੇਣ ਦਾ ਮੌਕਾ ਨਹੀਂ ਮਿਲਿਆ ਪਰ ਇਹ ਆ ਵੀ ਅਸੀਂ ਉਹਨਾਂ ਕੋਲ ਇੱਕ ਮੈਂ ਪਿੱਛੇ ਜਿਹੇ ਫੋਨ ਮੰਗਵਾਇਆ ਸੀ ਉਹ ਐਡਾ ਵਧੀਆ ਫੋਨ ਚੱਲਿਆ ਮੇਰਾ ਐਪਲ ਕੰਪਨੀ ਦਾ ਫੋਨ ਸੀ ਅਤੇ ਐਡਾ ਸ਼ਾਨਦਾਰ ਫੋਨ ਉਹ ਚੱਲਦਾ ਪਿਆ ਵਾ ਵੀ ਕੋਈ ਬਹੁਤ ਵਧੀਆ ਉਹਦੀ ਸਰਵਿਸ ਸਾਨੂੰ ਲੱਗੀ ਆ ਅਤੇ ਬਹੁਤ ਵਧੀਆ ਚੱਲਦਾ ਵਾ ਫੋਨ ਉਹ ਕੋਈ ਉਹਦਾ ਬੈਟਰੀ ਨਹੀਂ ਖ਼ਰਾਬ ਕੋਈ ਉਹਦਾ ਚਾਰਜ ਨਹੀਂ ਖ਼ਰਾਬ ਜੋ ਵੀ ਉਹਦਾ ਸਹੀ ਸਭ ਕੁਝ ਚੱਲਦਾ ਵਾ ਟਾਈਮ ਨਾਲ ਹੀ ਥੋੜ੍ਹੇ ਸਮੇਂ ਵਿੱਚ ਹੀ ਉਹ ਚਾਰਜ ਹੋ ਜਾਂਦਾ ਵਾ ਅਤੇ ਬਹੁਤ ਵਧੀਆ ਉਹਦਾ ਚੱਲਦਾ ਪਿਆ ਵਾ ਅਤੇ ਬਾਕੀ ਉਹ ਕਿਸੇ ਪੱਖੋਂ ਵੀ ਕੋਈ ਖ਼ਰਾਬ ਨਹੀਂ ਹੈਗਾ